ਆਵਾਜਾਈ ਦੇ ਸਾਧਨ ਬਹੁਤ ਹਨ ਲੇਕਿਨ ਜ਼ਿਆਦਾਤਰ ਅਸੀਂ ਬੱਸ ਜਾਂ ਸਕੂਟਰ ਮੋਟਰਸਾਈਕਲ ਦੀ ਹੀ ਵਰਤੋਂ ਕਰਦੇ ਹਾਂ ਦੂਰ ਜਾਣ ਲਈ ਬੱਸ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨੇੜੇ ਮੋਟਰਸਾਈਕਲ ਦੀ ਵਰਤੋਂ ਕੀਤੀ ਜਾਂਦੀ ਹੈ ਮੈਂ ਆਈ ਆਈ ਟੀ ਰੋਪੜ ਵਿਖੇ ਡਿਊਟੀ ਕਰਦਾ ਹਾਂ ਇਸ ਲਈ ਮੈਂ ਜ਼ਿਆਦਾ ਮੋਟਰਸਾਈਕਲ ਹੀ ਵਰਤਦਾ ਹਾਂ ਬੱਸ 'ਤੇ ਜਾਣ ਲਈ ਕਿਰਾਇਆ ਵਗੈਰਾ ਵੀ ਚਾਹੀਦਾ ਹੈ ਇਸ ਲਈ ਦੂਰ ਵਾਲ਼ੇ ਸਫ਼ਰ 'ਤੇ ਕਿਰਾਇਆ ਹੀ ਠੀਕ ਰਹਿੰਦਾ ਹੈ ਮੋਟਰਸਾਈਕਲ ਆਮ ਨੇੜੇ ਲੋਕਲ ਵਾਸਤੇ ਹੀ ਠੀਕ ਹੈ